ਸਤਿ ਸ਼੍ਰੀ ਅਕਾਲ ਪੰਜਾਬੀ ਭਾਸ਼ਾ ਭਾਰਤ ਦੀ ਇੱਕ ਪ੍ਰਮੁੱਖ ਭਾਸ਼ਾ ਹੈ ਜੋ ਖਾਸ ਕਰਕੇ ਪੰਜਾਬ ਸੂਬੇ ਵਿੱਚ ਬੋਲੀ ਜਾਂਦੀ ਹੈ ਇਹ ਭਾਸ਼ਾ ਸਿੱਖ ਧਰਮ ਦੇ ਲੋਕਾਂ ਵੱਲੋਂ ਵੀ ਬਹੁਤ ਬੋਲੀ ਜਾਂਦੀ ਹੈ ਅਤੇ ਸਿੱਖਾਂ ਦੀ ਪਵਿੱਤਰ ਕਿਤਾਬ ਗੁਰੂ ਗ੍ਰੰਥ ਸਾਹਿਬ ਵੀ ਇਸ ਭਾਸ਼ਾ ਵਿੱਚ ਹੀ ਲਿਖੀ ਗਈ ਸੀ ਪੰਜਾਬੀ ਭਾਸ਼ਾ ਦੀ ਭਾਰਤ ਵਿੱਚ ਕੀ ਪਹਿਲੁ ਪਹਿਲੂਆਂ ਵਿੱਚ ਮਹੱਤਵਪੂਰਨ ਭੂਮਿਕਾ ਹੈ ਹਾਂਜੀ ਪਹਿਲਾ ਪੁਆਇੰਟ ਸੰਸਕ੍ਰਿਤਿਕ ਅਤੇ ਵਿਰਾਸਤ ਪੰਜਾਬੀ ਭਾਸ਼ਾ ਪੰਜਾਬ ਦੀ ਸਮ੍ਰਿਤੀ ਸੰਸਕ੍ਰਿਤ ਵਿਰਾਸਤ ਦਾ ਇੱਕ ਅਹਿਮ ਭੂਮਿਕਾ ਹਿੱਸਾ ਹੈ ਇਹ ਭਾਸ਼ਾ ਲੋਕ ਗੀਤ ਲੋਕ ਨਾਚ ਜਿਵੇਂ ਕਿ ਭੰਗੜਾ ਅਤੇ ਗਿੱਧਾ ਅਤੇ ਤਿਉਹਾਰਾਂ ਜਿਵੇਂ ਕਿ ਵਿਸਾਖੀ ਲੋਹੜੀ ਆਦਿ ਨੂੰ ਵੀ ਵਿਅਕਤ ਕਰਦੀ ਹੈ ਇਹ ਭਾਸ਼ਾ ਸਮਾਜਿਕ ਅਰ ਸੰਸਕ੍ਰਿਤਿਕ ਜੁੜਾਵ ਨੂੰ ਮਜ਼ਬੂਤ ਕਰਦੀ ਹੈ ਦੂਸਰਾ ਪੁਆਇੰਟ ਸਾਹਿਤ ਅਤੇ ਕਲਾ ਪੰਜਾਬੀ ਸਾਹਿਤ ਨੇ ਭਾਰਤੀ ਸਾਹਿਤ ਨੂੰ ਕਈ ਮਹਾਨ ਲੇਖਕ ਅਤੇ ਕਵੀ ਦਿੱਤੇ ਹਨ ਜਿਵੇਂ ਕਿ ਧੰਨਵਾਦ